ਸਟੈਮ ਮਤਲਬ ਸਾਇੰਸ ਟੈਕਨੋਲੋਜੀ ਇੰਜੀਨੀਰਿੰਗ ਮਕ ਮੈਥਮੈਟਿਕਸ ਅੱਜ ਕੱਲ੍ਹ ਹਰ ਖੇਤਰ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਖੇਤੀਬਾੜੀ ਦਫ਼ਤਰ ਵਿੱਚ ਵੀ ਇਸਨੇ ਬਹੁਤ ਤਕਨੀਕੀ ਤਬਦੀਲੀਆਂ ਲਿਆਈ ਹੈ ਇਸ ਦੇ ਨਾਲ ਹੀ ਵਿਦਿਆਰਥੀ ਜ਼ਿਆਦਾ ਦੂਰ ਤੱਕ ਸੋਚ ਪਾ ਰਿਹਾ ਹੈ ਇਸ ਦੇ ਨਾਲ ਨਾਲ ਹੀ ਉਸਨੇ ਖੇਤਾਂ ਦੇ ਵਿਕਾਸ ਬਾਰੇ ਸੋਚਿਆ ਹੈ ਜੋ ਖੇਤਾਂ ਵਿੱਚੋਂ ਸਾਨੂੰ ਕਣਕ ਆਦਿ ਮਿਲ ਰਹੇ ਹਨ ਉਸ ਦੀ ਬਚਾਅ ਬਾਰੇ ਸੋਚਿਆ ਹੈ ਅਤੇ ਇਸ ਨੂੰ ਵਧਾਉਣ ਵਿੱਚ ਵੀ ਮਦਦ ਕੀਤੀ ਹੈ ਇਸ ਦੇ ਨਾਲ ਹੀ ਸਾਡੇ ਖੇਤੀਬਾੜੀ ਖੇਤਰ ਵਿੱਚ ਤਬਦੀਲੀ ਆਉਂਦੀ ਜਾ ਰਹੀ ਹੈ ਅਤੇ ਸਾਇੰਸ ਦਾ ਇਸਤੇਮਾਲ ਕਰਕੇ ਅਸੀ ਇਸ ਨੂੰ ਕਿੱਦਾ ਵਧਾ ਸਕਦੇ ਹਾਂ ਅਤੇ ਕਿੱਦਾਂ ਬਚਾ ਸਕਦੇ ਹਾਂ ਇਸ ਬਾਰੇ ਸਟੈਮ ਕਦਮ ਚੁੱਕ ਰਿਹਾ ਹੈ ਸਤੈਮ ਸਟੈਮ ਦੇ ਵਿਦਿਆਰਥੀ ਹਰ ਖੇਤਰ ਵਿੱਚ ਸੋਚ ਕੇ ਵਾਧਾ ਕਰਾ ਰਹੇ ਹਨ